ਹੈਲੋ ਹਾਂਜੀ ਕੌਣ ਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਗੁਆਂਡੋ ਬੋਲਦੇ ਆ ਪਰ ਮੈਨੂੰ ਲੱਗਦਾ

ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਆਪਣੇ ਬੱਚਿਆਂ ਦਾ ਕੀ ਹਾਲ ਚਾਲ ਹੈ ਸਾਰੇ ਵਧੀਆ ਛਾਲਾਂ ਮਾਰਦੇ ਆ ਮੌਜਾਂ ਕਰਦੇ ਆ ਦੱਸੋ ਜੀ ਹਾਂ ਹਾਂ ਇਸ 'ਤੇ ਬੜਾ ਵੱਡਾ ਟੋਆ ਬਣਿਆ ਪਿਆ ਲੰਘਣਾ ਟੱਪਣਾ ਬਹੁਤ ਔਖਾ ਹੋਇਆ ਖੜ੍ਹਾ ਯਾਰ ਇਹ ਕਰਾਉਣ 'ਚ ਫਾਇਦਾ ਹੀ ਆ ਪਰ ਟੋਏ ਦਾ ਨੁਕਸਾਨ ਬਹੁਤ ਹੈ ਆਪਾਂ ਇੱਕ ਇੱਕ ਦੂਜੇ ਆ ਸਕਦੇ ਨਹੀਂ ਆਪਾਂ ਹਾਂ ਅੱਗੇ ਲੱਗਣ ਨਾਲ ਹੀਲਾ ਵਸੀਲਾ ਹੋਣਾ ਫਿਰ ਹੀ ਲਾਂਘਾ ਬਣੂੰਗਾ

ਨਹੀਂ ਅਤੇ ਬੱਚਿਆਂ ਨਹੀਂ ਅਤੇ ਬੱਚਿਆਂ ਨੂੰ ਬਹੁਤ ਔਖਾ ਲੰਘਣਾ ਟੱਪਣਾ ਘਰੇ ਇੱਕ ਦੂਜੇ ਦੇ ਆਉਣਾ ਜਾਣਾ ਹਾਂਜੀ ਉਹ ਟੋਏ 'ਚ ਪਾਣੀ ਆ ਜਦੋਂ ਟੱਪਦੇ ਆ ਚਿੱਕੜ ਵੀ ਉੱਥੇ ਛਿੱਟੇ ਮਾਰ ਕੇ ਉਹ ਜਾਂਦੇ ਆ ਨੁਕਸਾਨ ਬਹੁਤ ਕਰਦੇ ਆ ਕੋਈ ਵੀ ਟੱਪੇ ਸਾਰਿਆਂ ਨੂੰ ਹੀ ਔਖਾ ਹੋਇਆ ਖੜ੍ਹਾ ਇਹ ਤਾਂ ਨਹੀਂ ਸਹੀ ਗੱਲ ਹੈ ਸਹੀ ਹੈ ਇਹਦਾ ਟੋਏ ਦਾ ਤਾਂ ਹੱਲ ਕਰਾਈਏ ਕੋਈ ਇਹ ਤਾਂ ਠੀਕ ਆ ਬਸ ਲੋਕ ਇੱਕ ਸਾਲ ਬਾਹਰ ਕੰਮਾਂ 'ਚ ਜਾ ਵੜਦੇ ਆ ਇਸ ਵੇਲੇ ਮੰਦਾ ਜਿਹਾ ਹੋ ਜਾਂਦਾ ਸੁਬਹਾ ਸ਼ਾਮ ਗਾਹਕ ਆਉਂਦਾ ਹੀ ਹੈ ਮਾੜਾ ਮੋਟਾ ਚਲ ਆਈ ਚਲਾਈ ਚੱਲੀ ਜਾਂਦੀ ਆ ਬਸ ਇੰਨੇ ਨਾਲ ਜੀ ਲੱਗਿਆ ਰਹਿੰਦਾ ਸਹੀ ਗੱਲ ਆ ਸਹੀ ਗੱਲ ਆ ਨਾਲੇ ਦਿਨ ਸੌਖਾ ਟੱਪੇਗਾ ਦੁਕਾਨ 'ਤੇ ਹਮ ਠੀਕ ਚਲ ਜੇ ਵਧੀਆ ਬਣ ਜਾਏਗਾ ਟੋਆ ਭਰਵਾ ਦਈਏ ਕੋਈ ਚਲ ਚਾਰ ਪੈਸੇ ਕੋਲੋਂ ਵੀ ਰਲ ਮਿਲ ਕੇ ਆਂਢ ਗੁਆਂਢ ਲਾ ਦਿਆਂਗੇ ਆਪਾਂ ਇਹ ਸਾਰਿਆਂ ਨੂੰ ਸੌਖਾ ਹੋ ਜੂ ਸਾਰਿਆਂ ਨੂੰ ਹੀ ਸੋਹਣੇ ਲੱਗਦੇ ਆ ਹਾਂ ਹਾਂ ਇਹ ਨਾ ਬ ਪਾਣੀ ਖੜ੍ਹਨ ਮੱਛਰ ਹੀ ਬਹੁਤ ਜ਼ਿਆਦਾ ਗੰਦ ਬਣਿਆ ਖੜ੍ਹਾ ਲੰਘਣਾ ਟੱਪਣਾ ਹੀ ਔਖਾ ਹੋਇਆ ਖੜ੍ਹਾ ਇਸ ਤੋਂ ਨਹੀਂ ਨਹੀਂ ਆ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਟੋਏ ਬਾਰੇ ਨਹੀਂ ਤਾਂ ਬਹੁਤ ਔ ਔਖਾ ਹੀ ਔਖਾ ਹੋਇਆ ਖੜ੍ਹਾ ਨਹੀਂ

ਹਾਂ ਹਾਂ ਠੀਕ ਨਹੀਂ ਆਹ ਵਧੀਆ ਕੀਤੀ ਗੱਲ ਸਾਡੇ ਨਾਲ ਤੁਸੀਂ ਗੁਆਂਢੀਆਂ ਨੇ ਗੁਆਂਢੀ ਵੀ ਇਹੋ ਜਿਹੇ ਹੋਣੇ ਚਾਹੀਦੇ ਜਿਹੜੇ ਕੋਈ ਉਹ ਜਿਹੜਾ ਨਫਾ ਨੁਕਸਾਨ ਹੋਵੇ ਜਿਹੜਾ ਕਰੇ ਵਧੀਆ ਹਮ ਬਸ ਫਿਰ ਹਾਂ ਨਹੀਂ ਠੀਕ ਕਰਨਾ ਹੀ ਪਊ ਬਹੁਤ ਵਧੀਆ ਕੀਤੀ ਗੱਲ ਤੁਸੀਂ ਠੀਕ ਹੈ ਠੀਕ ਹੈ ਠੀਕ ਬਹੁਤ ਧੰਨਵਾਦ